ਪੰਜਾਬ ਵਿੱਚ ਬਹੁਤ ਸਾਰੇ ਵਿਕਲਪ ਹਨ ਜਿਸ ਤਰ੍ਹਾਂ ਕਿ ਜਦੋਂ ਵੀ ਕੋਈ ਵੀ ਬਾਹਰੋਂ ਸੈਲਾਨੀ ਇੱਥੇ ਪੰਜਾਬ ਵਿੱਚ ਆਉਂਦਾ ਹੈ ਉਸਨੂੰ ਕਿਸੇ ਤਰ੍ਹਾਂ ਦੇ ਨਾਲ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਕਿਉਂਕਿ ਜੋ ਵੀ ਜਿੱਥੇ ਦਿਨ ਤਿਉਹਾਰ ਜੋ ਵੀ ਹੁੰਦਾ ਹੈ ਉਸ 'ਤੇ ਨੂੰ ਲੈ ਕੇ ਬੜੀ ਤਰ੍ਹਾਂ ਦੇ ਉੱਥੇ ਇਸ਼ਤਿਹਾਰ ਦਿੱਤੇ ਜਾਂਦੇ ਹਨ ਇਸ਼ਤਿਹਾਰਾਂ 'ਤੇ ਸਾਰਾ ਵੇਰਵਾ ਲਿਖਿਆ ਹੁੰਦਾ ਹੈ ਕਿ ਕਿਹੜਾ ਪ੍ਰੋਗਰਾਮ ਕਿੱਥੇ ਹੋ ਰਿਹਾ ਹੈ ਕਿਸ ਤਰ੍ਹਾਂ ਕਿਸ ਸਥਾਨ ਤੋਂ ਪਹੁੰਚਣਾ ਹੈ ਉਹ ਸੜਕ ਦੇ ਉੱਤੇ ਇਸ਼ਾਰੇ ਨਾਲ ਇ ਇਸ਼ਾਰਾ ਦਿੱਤਾ ਹੁੰਦਾ ਹੈ ਕਿ ਆਪਾਂ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜਾਣਾ ਹੈ ਜਾਂ ਕਿਤੇ ਹੋਰ ਜਾਣਾ ਹੈ ਚੱਬਾ ਪਿੰਡ ਹੈ ਸਾਡੇ ਤਰਨਤਾਰਨ ਦੇ ਕੋਲ ਅਤੇ ਨਾਲ ਕਿੱਥੇ ਕਿਸ ਤਰ੍ਹਾਂ ਉਸੇ ਇਸ਼ਾਰਾ ਦਿੱਤਾ ਹੁੰਦਾ ਕਿ ਇਹ ਸੜਕ ਇਸ ਬਾਬਾ ਬੁੱਢਾ ਸਾਹਿਬ ਨੂੰ ਜਾ ਰਹੀ ਹੈ ਜਾਂ ਚੱਬੇ ਨੂੰ ਜਾ ਰਹੀ ਹੈ ਜਾਂ ਕਿੱਥੇ ਜਾ ਰਹੀ ਇਸ ਤਰ੍ਹਾਂ ਨਾਲ ਬਹੁਤ ਹੀ ਸੌਖੀ ਤਰ੍ਹਾਂ ਨਾਲ ਸੈਲਾਨੀ ਇੱਥੇ ਆ ਕੇ ਜਾ ਆ ਆ ਜਾ ਸਕਦੇ ਹਨ ਜਿੱਥੇ ਵੀ ਉਹ ਜ਼ਰੂਰਤ ਹੋਵੇ ਉਹਨਾਂ ਨੂੰ ਉੱਥੇ ਜਾ ਸਕਦੇ ਹਨ ਕੋਈ ਵੀ ਸਾਡੇ ਕੋਈ ਦਿਨ ਤਿਉਹਾਰ ਹੁੰਦਾ ਕੁਛ ਵੀ ਜਾਂ ਗੁਰਮਤਿ ਸਮਾਗਮ ਹੁੰਦੇ ਨੇ ਕਿਸੇ ਤਰ੍ਹਾਂ ਬਾਬਾ ਜੀ ਦਾ ਕੋਈ ਪ੍ਰਕਾਸ਼ ਦਿਹਾੜਾ ਕਿਸੇ ਤਰ੍ਹਾਂ ਦਾ ਕੁਛ ਵੀ ਹੁੰਦਾ ਉਸ ਉਸ ਲਈ ਅਸੀਂ ਇੱਕ ਉੱਥੇ ਇਸ਼ਤਿਹਾਰ ਲਾ ਉੱਥੇ ਇਸ਼ਤਿਹਾਰ ਲਗਾਇਆ ਹੁੰਦਾ ਹਨ ਜਿੱਥੇ ਕਿ ਸਾਰਾ ਵੇਰਵਾ ਦਿੱਤਾ ਹੁੰਦਾ ਹੈ ਕਿ ਇੰਨੀ ਤਰੀਕ ਨੂੰ ਇਸ ਜਗ੍ਹਾ 'ਤੇ ਇਸ ਸਥਾਨ ਦੇ ਉੱਤੇ ਇਹ ਗੁਰਮਤਿ ਸਗਾ ਸਮਾਗਮ ਹੋ ਰਿਹਾ ਹੈ ਜਾਂ ਇੱਥੇ ਕੋਈ ਕਬੱਡੀ ਦਾ ਮੈਚ ਹੈ ਜਾਂ ਕੋਈ ਭੰਗੜੇ ਦਾ ਹੈ ਜਾਂ ਕੋਈ ਹੋਰ ਦਿਨ ਤਿਉਹਾਰ ਹੈ ਜਿਸ ਤਰ੍ਹਾਂ ਲੋਹੜੀ ਦਾ ਤਿਉਹਾਰ ਹੈ ਦਿਵਾਲੀ ਹੈ ਕਿਤੇ ਕੀ ਮਤਲਬ ਹੈ ਨਾ ਜੋ ਵੀ ਹੈ ਇਸ ਤਰ੍ਹਾਂ ਨਾਲ ਸਾਰੀ ਸਾਡਾ ਵੇਰਵਾ ਇਸ਼ਤਿਹਾਰਾਂ ਦੇ ਦੇ ਉੱਤੇ ਲਿਖਿਆ ਹੁੰਦਾ ਜਿਸ ਨਾਲ ਬੜੀ ਸੌਖੀ ਤਰ੍ਹਾਂ ਨਾਲ ਕੀ ਸੈਲਾਨੀ ਆ ਕੇ ਇੱਥੇ ਉਸਦਾ ਆਨੰਦ ਮਾਣ ਸਕਦੇ ਹਨ ਜਾ ਕੇ ਸਾਡੇ ਦਿਨ ਤਿਉਹਾਰਾਂ ਦੇ ਉੱਤੇ ਲੋਹੜੀ ਮਾਘੀ ਦਿਵਾਲੀ ਵਿਸਾਖੀ ਜੋ ਜਿੰਨੇ ਦਿਨ ਤਿਉਹਾਰ ਹਨ ਉਸ ਉਸ ਨੂੰ ਲੈ ਕੇ ਹਰ ਤਰ੍ਹਾਂ ਨਾਲ ਬੜੇ ਸੌਖੇ ਤਰੀਕੇ ਨਾਲ ਸਾਡੇ ਪੰਜਾਬ ਵਿੱਚ ਸਮਝਾਇਆ ਜਾਂਦਾ ਹੈ ਜਿਸ ਨਾਲ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਔਖਾ ਨਹੀਂ ਹੁੰਦਾ ਉਹ ਬੜੀ ਸ਼ਰਧਾ ਨਾਲ ਇੱਥੇ ਪੰਜਾਬ ਦੇ ਵਿੱਚ ਆਉਂਦੇ ਹਨ ਗੁਰਦੁਆਰੇ ਜਾਂਦੇ ਹਨ ਹੋਰ ਇਸਦਾ ਇਤਿਹਾਸਿਕ ਸਥਾਨ ਹਨ ਸਾਡੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਓ ਉਹਨਾਂ ਜ ਜਿਹੜੇ ਉਹਨਾਂ ਨੂੰ ਦਰਸ਼ਨ ਕਰਨ ਆਉਂਦੇ ਹਨ ਹੈ ਨਾ ਸਾਡੇ ਦਿਨ ਤਿਉਹਾਰ ਪੰਜਾਬ ਦੇ ਤਿਉਹਾਰ ਤਾਂ ਬਹੁਤ ਹੀ ਵੇਖਣ ਵਾਲੇ ਹੁੰਦੇ ਹਨ ਜਿਸ ਇੱਥੇ ਬਾਹਰੋਂ ਆ ਕੇ ਵਿਅਕਤੀ ਇੰਨੇ ਦੁਨੀਆ ਇੰਨੀ ਖੁਸ਼ ਹੁੰਦੀ ਹੈ ਕਿ ਪੰਜਾਬ ਵਰਗੀ ਕਿਤੇ ਵੀ ਰੀਸ ਨਹੀਂ ਹੈ ਪੰਜਾਬ ਇੱਕ ਐਸਾ ਦੇਸ਼ ਹੈ ਸਾਡਾ ਕਿ ਜਿੱਥੇ ਹਰ ਦਿਨ ਤਿਉਹਾਰ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਜਾਦਾ ਹੈ ਸਾਡੇ ਰਸਤੇ ਵਿੱਚ ਸੈਲਾਨੀਆਂ ਨੂੰ ਕੋਈ ਵੀ ਕਿਸੇ ਤਰ੍ਹਾਂ ਨਾਲ ਥਾਂ ਥਾਂ 'ਤੇ ਗੁਰਦੁਆਰੇ ਨੇ ਥਾਂ ਥਾਂ 'ਤੇ ਲੰਗਰ ਨੇ ਲੱਗੇ ਹੁੰਦੇ ਨੇ ਕੋਈ ਵੀ ਕਿਸੇ ਤਰ੍ਹਾਂ ਨਾਲ ਕਿਸੇ ਨੂੰ ਵੀ ਔਖਾ ਨਹੀਂ ਹੁੰਦਾ ਬੜੀ ਸੌਖੀ ਤਰ੍ਹਾਂ ਨਾਲ ਉਹਨੂੰ ਹਰ ਤਰ੍ਹਾਂ ਨਾਲ ਉਹਨਾਂ ਨੂੰ ਹਰ ਚੀਜ਼ ਮਿਲ ਜਾਂਦੀ ਹੈ ਇਸ ਕਰਕੇ ਸਾਨੂੰ ਮਾਣ ਹੈ ਆਪਣੇ ਪੰਜਾਬ ਦੇ ਉੱਤੇ ਜੋ ਵੀ ਸੜਕਾਂ ਦੇ ਉੱਤੇ ਸਾਡੇ ਕੋਈ ਸੜਕਾਂ 'ਤੇ ਦਿਨ ਤਿਉਹਾਰ ਨੂੰ ਸਾਡੇ ਗੁਰੂ ਸਾਹਿਬਾਨਾਂ ਦੇ ਦਰ ਪ੍ਰਕਾਸ਼ ਦਿਹਾੜੇ ਦੇ ਵਿੱਚ ਕਿਨ ਨਗਰ ਕੀਰਤਨ ਹੁੰਦੇ ਹਨ ਨਗਰ ਕੀਰਤਨ ਦੇ ਵਿੱਚ ਲੋਕ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਲੰਗਰ ਚਾਹ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਹੋਰ ਮਤਲਬ ਬੜੀ ਸ਼ਰਧਾ ਨਾਲ ਸੇਵਾ ਕਰਦੇ ਹਨ ਜਿਸ ਹਿਸਾਬ ਨਾਲ ਹਰ ਤਰ੍ਹਾਂ ਗਰੀਬ ਅਮੀਰ ਜਿਸ ਤਰ੍ਹਾਂ ਦਾ ਬੰਦ ਜੋ ਵੀ ਹੋਵੇ ਹਰ ਚੀਜ਼ ਹਰ ਬੰਦਾ ਇਸ ਨੂੰ ਛਕ ਸਕਦਾ ਹੈ ਇਸ ਕਰਕੇ ਸਾਡਾ ਪੰਜਾਬ ਜਿਹੜਾ ਨਾ ਸਾਡੇ ਪੰਜਾਬ ਦੇ ਜਿਹੜੇ ਵਿਕਲਪ ਹਨ ਬਹੁਤ ਹੀ ਅਦਭੁਤ ਹਨ ਸਾਰੀ ਦੁਨੀਆ ਨੂੰ ਅਲੱਗ ਹਨ ਇੱਥੇ ਬੜੇ ਇਤਿਹਾਸਿਕ ਸਥਾਨ ਜਲਿਆਂਵਾਲਾ ਬਾਗ ਹੈ ਦੁਰਗਿਆਣਾ ਮੰਦਰ ਹੈ ਹਰਿਮੰਦਰ ਸਾਹਿਬ ਸ਼ਹੀਦਾਂ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਹੋਰ ਬੜੇ ਸਥਾਨ ਹਨ ਜੋ ਕਿ ਦੇਖਣ ਦੇ ਯੋਗ ਹੈ ਇਸ ਨੂੰ ਅਸੀਂ ਬੜੇ ਸੌਖੇ ਤਰੀਕੇ ਨਾਲ ਸਾਨੂੰ ਬਾਹਰੋਂ ਜਿਹੜੇ ਸੈਲਾਨੀ ਆਉਂਦੇ ਆ ਉਹਨੂੰ ਬੜਾ ਸੌਖੇ ਤਰੀਕੇ ਨਾਲ ਉਹਨੂੰ ਲੱਭ ਸਕਦੇ ਹਨ ਜਿਸ ਨਾਲ ਇਸ਼ਾਰਾ ਦਿੱਤਾ ਹੁੰਦਾ ਹੈ ਕਿ ਇਸ ਇਸ ਜਗ੍ਹਾ ਸ ਇਸ ਇਸ ਪਾਸੇ ਇਹ ਸਥਾਨ ਹੈ ਇਸ ਕਰਕੇ ਮਤਲਬ ਇਹ ਵਿਕਲਪ ਸਾਡੇ ਪੰਜਾਬ ਵਿੱਚ ਬਹੁਤ ਹੀ ਜਿਹੜੇ ਹੈ ਸੈਲਾਨੀ ਇੱਥੇ ਆ ਕੇ ਅਜ਼ਮਾ ਸਕਦੇ ਹਨ ਜਿਸ ਨਾਲ ਉਹਨਾਂ ਨੂੰ ਬੜੇ ਹੀ ਸੌਖੇ ਤਰੀਕੇ ਨਾਲ ਹਰ ਚੀਜ਼ ਮਿਲ ਜਾਂਦੀ ਹੈ ਧੰਨਵਾਦ